ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਜੀ ਤੁਸੀਂ ਸੁਣਾਓ ਕੋਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਆਪਣੇ ਹਾਂਜੀ ਆਪਣੇ ਜਿਵੇਂ ਹੁਣ ਮੇਨ ਤਾਂ ਆਪਣੇ ਬਿਆਸ ਅਤੇ ਰਾਵੀ ਦਾ ਸੰਗਮ ਹੁੰਦਾ ਹਰੀਕੇ ਪੱਤਣ ਉੱਥੇ ਸਤਲੁਜ ਦਰਾ ਦਰਿਆ ਫਿਰ ਉਹ ਅੱਗੇ ਪਾਕਿਸਤਾਨ ਨੂੰ ਜਾਂਦਾ ਅਤੇ ਉੱਥੋਂ ਹੀ ਆਪਣੇ ਜਿਹੜੀਆਂ ਕਿ ਦੋ ਨਹਿਰਾਂ ਇੱਕ ਰਾਜਸਥਾਨ ਨਹਿਰ ਇੱਕ ਫਿਰੋਜ਼ਪੁਰ ਫੀਡਰ ਹੈ ਦੋ ਨਹਿਰਾਂ ਸਿੰਜਾਈ ਲਈ ਸਿੰਚਾਈ ਲਈ ਨਿਕਲਦੀਆਂ ਉੱਥੋਂ ਅਤੇ ਉਹ ਜਿਹੜੀਆਂ ਫਰੀਦਕੋਟ ਅਤੇ ਅਗਾਂਹ ਰਾਜਸਥਾਨ ਨੂੰ ਉਹ ਹੀ ਨਹਿਰਾਂ ਜਾਂਦੀਆਂ ਆਪਣੇ ਜਿਹੜੀਆਂ ਕਿ ਆਪਣੇ ਖੇਤਾਂ ਦੀ ਸਿੰਚਾਈ ਵਗੈਰਾ ਲਈ ਸਭ ਤੋਂ ਜ਼ਿਆਦਾ ਯੂਜ਼ ਕੀਤੀਆਂ ਜਾਂਦੀਆਂ ਅਤੇ ਬਾਕੀ ਹੋਰ ਆਪਣੇ ਰੋਪੜ ਗੁਰਦਾਸਪੁਰ ਇਹ ਸਾਈਡ ਵੀ ਆਪਣੀਆਂ ਨਹਿਰਾਂ ਹੈਗੀਆਂ ਅਤੇ ਇੱਕ ਜਿਹੜੇ ਆਪਣੇ ਇੱਕ ਨਹਿਰ ਹੋਰ ਜਿਹੜੀਆਂ ਉੱਥੋਂ ਦੋ ਨਿਕਲੀਆਂ ਉੱਥੇ ਇੱਕ ਹੋਰ ਪ੍ਰੋਸੈਸ ਚੱਲ ਰਿਹਾ ਵੀ ਤੀਜੀ ਨਹਿਰ ਹੋਰ ਕੱਢਣ ਬਾਰੇ ਸੋਚ ਰਹੇ ਹੈ ਵੀ ਇੱਕ ਹੋਰ ਨਹਿਰ ਕੱਢੀ ਜਾਊਗੀ ਵੀ ਜਿਹੜੀ ਕਿ ਆਪਣੇ ਆਹੀ ਸਿੰਚਾਈ ਸੁੰਚਈ ਲਈ ਕੰਮ ਆਇਆ ਕਰੂਗੀ ਅਤੇ ਹਾਂਜੀ ਹੋਰ ਹਾਂਜੀ ਪਾਣੀ ਦੇ ਬਚਾਓ ਬਾਰੇ ਤਾਂ ਬਸ ਇਹ ਹੀ ਹੈ ਨਾ ਵੀ ਆਪਾਂ ਆਪਣਾ ਲੋ ਸਾਰਿਆਂ ਨੂੰ ਦੱਸਦੇ ਰਹੀ ਦਾ ਵੀ ਪਾਣੀ ਦਾ ਬਚਾਓ ਕਿਸ ਤਰ੍ਹਾਂ ਕਰਨਾ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਰਹਿਣਾ ਵੀ ਉਹਨੂੰ ਆਏ ਘੱਟ ਡੋਲੋ ਜਾਂ ਕੱਪੜੇ ਧੋਣ ਵਗੈਰਾ ਲਈ ਜਿਵੇਂ ਘੱਟ ਉਸ ਹਿਸਾਬ ਨਾਲ ਲਿਮਿਟ ਦਾ ਯੂਜ਼ ਕਰੋ ਜਾਂ ਕਿਤੇ ਵੀ ਆਪਾਂ ਬਸ ਇਹੀ ਦੱਸਦੇ ਹਾਂ ਵੀ ਚਲੋ ਜਿੱਥੇ ਹੋ ਸਕੇ ਉਨਾ ਕੁ ਬਚਾਅ ਹੋਵੇ ਪਾਣੀ ਦਾ ਵੀ ਜਿਹੜਾ ਤਾਂ ਆਪਾਂ ਨੂੰ ਜਾ ਕੇ ਅੱਗੇ ਜਾ ਕੇ ਕੋਈ ਦਿੱਕਤਾਂ ਨਾ ਹੋਣ ਇਸ ਤਰ੍ਹਾਂ ਤੁਹਾਨੂੰ ਪਤਾ ਅੱਜ ਕੱਲ੍ਹ ਨਹਿਰਾਂ ਵਿੱਚ ਜੋ ਵੀ ਆਪਾਂ ਫ਼ਸਲ ਵਗੈਰਾ ਉਗਾਉਂਦੇ ਤਾਂ ਹੈ ਨਾ ਸਿੰਚਾਈ ਲਈ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਕਰਕੇ ਵੀ ਪਹਿਲਾਂ ਸਮੇਂ ਸਮੇਂ 'ਤੇ ਲੋਕਾਂ ਨੂੰ ਅਵੇਅਰ ਕਰੀ ਪਾਣੀ ਦੀ ਲਿਮਿਟ 'ਚ ਵਰਤੋਂ ਜਿੰਨਾ ਕੁ ਜ਼ਰੂਰਤ ਹੈ ਉਨਾ ਹੀ ਵਰਤੋਂ ਅਤੇ ਉਹ ਜਿੰਨਾ ਹੋ ਸਕੇ ਹਾਂਜੀ ਹਾਂਜੀ ਹਾਂ ਸਾਨੂੰ ਪਾਣੀ ਸਮੇਂ ਸਮੇਂ ਦੇ ਵਿੱਚ ਮਿਲਦਾ ਰਹਿੰਦਾ ਹਜੇ ਤੱਕ ਤਾਂ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਅਤੇ ਬਾਕੀ ਕੁਛ ਕਰਨ ਜਿਵੇਂ ਕਈ ਥਾਵਾਂ 'ਤੇ ਨਲਕਿਆਂ ਰਾਹੀਂ ਪਾਣੀ ਨੀਚੋਂ ਬੋਰ 'ਚੋਂ ਹੀ ਚੱਕਦੇ ਹੈ ਅਤੇ ਇਸ ਕਰਕੇ ਪਾਣੀ ਪੁਣੀ ਤਾਂ ਸਮੇਂ ਸਿਰ ਮਿਲਦਾ ਰਹਿੰਦਾ ਹਜੇ ਤਾਈਂ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਜਿਵੇਂ ਭਵਿੱਖ 'ਚ ਬਸ ਇਸ ਤਰ੍ਹਾਂ ਜਿੱਦਾਂ ਹੁਣ ਅਗਾਂਹ ਜਾ ਕੇ ਭਵਿੱਖ 'ਚ ਨਾ ਕੋਈ ਦਿੱਕਤ ਆਵੇ ਹਾਂ ਉਸ ਕਰਕੇ ਥੋੜ੍ਹਾ ਜਿਹਾ ਆਪਣੀ ਕੋਸ਼ਿਸ਼ ਰੱਖੀ ਦੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਰਨਾ ਹੀ ਚਾਹੀਦਾ ਬਸ ਇਹੀ ਹੈ ਆਪਾਂ ਸਾਰਿਆਂ ਨੂੰ ਤਾਂ ਇਹੀ ਹੈ ਆਪਾਂ ਤਾਂ ਆਪਣੇ ਬਾਰੇ ਦੇਖੋ ਬੱਚੇ ਘਰ ਬੱਚਿਆਂ ਨੂੰ ਵੀ ਇਹੀ ਚੀਜ਼ ਸਿਖਾਉਂਦੇ ਹਾਂ ਵੀ ਤੁਸੀਂ ਫਾਲਤੂ ਪਾਣੀ ਨਾ ਡੋਲ੍ਹੋ ਜਿੰਨਾ ਕੁ ਜ਼ਰੂਰਤ ਹੈ ਹੈ ਨਾ ਉਨਾ ਕੁ ਡੋਲ੍ਹੋ ਕਿਉਂਕਿ ਨਾ ਅੱਗੇ ਜਾ ਕੇ ਜਿਹੜੀਆਂ ਆਪਣੀਆਂ ਪੀੜ੍ਹੀਆਂ ਮੰਨ ਲਓ ਉਹਨਾਂ ਨੂੰ ਨਾ ਕੋਈ ਦਿੱਕਤ ਆਵੇ ਇਸ ਚੱਕਰ 'ਚ ਅਤੇ ਬਾਕੀ ਹੁਣ ਜਿਵੇਂ ਫ਼ਸਲਾਂ ਵਗੈਰਾ ਝੋਨੇ ਵਗੈਰਾ ਦੀ ਸਿੰਚਾਈ ਹੋਣ ਲੱਗੀ ਹੈ ਅਤੇ ਝੋਨੇ ਲਈ ਇਸ ਤਰ੍ਹਾਂ ਤਾਂ ਤੁਹਾਨੂੰ ਪਤਾ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਹੀ ਕਹੀ ਦਾ ਵੀ ਚਲੋ ਜਿੰਨਾ ਵੀ ਬਚਾ ਹੋ ਸਕੇ ਉਨਾ ਚੰਗਾ ਕਿਉਂਕਿ ਫਿਰ ਫ਼ਸਲਾਂ ਲਈ ਵੀ ਪਾਣੀ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਅਤੇ ਬਾਕੀ ਬਸ ਇਹੀ ਹੈ ਵੀ ਹਾਂਜੀ ਹੋਰ ਵੀ ਕਾਫੀ ਸਾਈਡਾਂ ਤੋਂ